ਸ਼ਾਰਕ ਟੈਂਕ ਇੱਕ ਅਨੋਖਾ ਅਤੇ ਦਿਲਚਸਪ ਟੀ ਵੀ ਸ਼ੋਅ ਹੈ ਜੋ ਨਵੇਂ ਨਵੇਂ ਬਿਜਨਸਮੈਨਾਂ ਨੂੰ ਇੱਕ ਨਵਾਂ ਬਿਜਨਸ ਕਰਨ ਦਾ ਮੌਕਾ ਦਿੰਦਾ ਹੈ ਸ਼ਾਰਕ ਟੈਂਕ ਇੱਕ ਅਮਰੀਕੀ ਬਿਜਸ ਰਿਐਲਿਟੀ ਟੈਲੀਵਿਜ਼ਨ ਸੀਰੀਸ ਹੈ ਜਿਸਦਾ ਪ੍ਰੀਮੀਅਰ ਨੋਂ ਅਗਸਤ ਦੋ ਹਜ਼ਾਰ ਨੌ ਨੂੰ ਏ ਬੀ ਸੀ 'ਤੇ ਹੋਇਆ ਸੀ ਇਹ ਸ਼ੋ ਅੰਤਰਰਾਸ਼ਟਰੀ ਫਾਰਮੈਟ ਡਰੈਗਨਸ ਦੇਣ ਦੀ ਅਮਰੀਕੀ ਫ੍ਰਾਈਚੈਜੀ ਹੈ ਜੋ ਇੱਕ ਜਪਾਨੀ ਟੀ ਵੀ ਸੀਰੀਜ਼ ਹੈ ਇਹ ਉਦਮੀਆਂ ਨੂੰ ਪ੍ਰੋਗਰਾਮ 'ਤੇ ਸਾਰਕ ਨਾਮਕ ਪੰਜ ਪੂੰਜੀਪਤੀਆਂ ਦੇ ਇੱਕ ਪੈਨਲ ਨੂੰ ਕਾਰੋਬਾਰੀ ਪੇਸ਼ਕਾਰੀ ਦਿੰਦਾ ਹੈ ਜੋ ਫੈਸਲਾ ਕਰਦੇ ਹਨ ਕਿ ਉਹਨਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨਾ ਹੈ ਜਾਂ ਨਹੀ ਇਹ ਲੜੀ ਆਪਣੇ ਟਾਈਮ ਸਲਾਟ ਵਿੱਚ ਇੱਕ ਰੇਟਿੰਗ ਸਫਲਤਾ ਰਹੀ ਹੈ ਜਿਸ ਨੂੰ ਉਸ ਸ਼੍ਰੈਣੀ ਦੀ ਹੋਂਦ ਦੇ ਪਹਿਲੇ ਚਾਰ ਸਾਲਾਂ ਵਿੱਚ ਦੋ ਹਜ਼ਾਰ ਚੌਦਾਂ ਤੋਂ ਦੋ ਹਜ਼ਾਰ ਸਤਾਰਾਂ ਵਿੱਚ ਆਊਟ ਸਟੈਂਡਿੰਗ ਸਟਰਕਚਰਡ ਰਿਐਲਟੀ ਪ੍ਰੋਮਰਲੀ ਪ੍ਰਾਈਮ ਟਾਈਮ ਐਮੀ ਅਵਾਰਡ ਜਿੱਤਿਆ ਗਿਆ ਸ਼ ਸ਼ੋਅ ਵਿੱਚ ਨਿਵੇਸ਼ਕਾਂ ਦਾ ਇੱਕ ਪੈਨਲ ਹੈ ਜਿਸ ਨੂੰ ਸ਼ਰਕ ਕਿਹਾ ਜਾਂਦਾ ਹੈ ਜੋ ਇਹ ਫੈਸਲਾ ਕਰਦੇ ਹਨ ਕਿ ਉਦਮੀਆਂ ਦੁਆਰਾ ਆਪਣੀ ਕੰਪਨੀ ਜਾਂ ਉਤਪਾਦ 'ਤੇ ਕਾਰੋਬਾਰੀ ਪੇਸ਼ਕਾਰੀ ਕਰਨ ਲਈ ਨਿਵੇਸ਼ ਕਰਨਾ ਹੈ ਜਾਂ ਨਹੀਂ ਸਾਰਕ ਅਕਸਰ ਕਿਸੇ ਉਦਮੀ ਦੇ ਉਤਪਾਦ ਕਾਰੋਬਾਰੀ ਮਾਡਲ ਜਾਂ ਆਪਣੀ ਕੰਪਨੀ ਦੇ ਮੁਲਾਂਕਣ ਵਿੱਚ ਕਮਜ਼ੋਰੀਆਂ ਅਤੇ ਨੁਕਸ ਲੱਭਦੇ ਹਨ ਕੁਝ ਨਿਵੇਸ਼ਕ ਆਮ ਤੌਰ 'ਤੇ ਦਿਆਲੂ ਹੁੰਦੇ ਹਨ ਅਤੇ ਅਸ ਅਸਵੀਕਾਰ ਦੇ ਪ੍ਰਭਾਵ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਪੈਨਲ ਦੀ ਮੈਂਬਰ ਬਰਬਰਾ ਕੋਰਕੋਰਨ ਜਦੋਂ ਕਿ ਕੇਵਨ ਪਲੇਰੀ ਵਰਗੇ ਹੋਰ ਕਈ ਥੋੜ੍ਹੇ ਸਖਤ ਹੋ ਸਕਦੇ ਹਨ ਮੁਸ਼ਕਿਲਾਂ ਦੀਆਂ ਕਹਾਣੀਆਂ ਲਈ ਵੀ ਸਬਰ ਨਹੀਂ ਦਿਖਾ ਸਕਦੇ ਸ਼ਾਰਕ ਨੂੰ ਸ਼ੋਅ ਦੇ ਕਾਸ਼ਟ ਸਿਤਾਰਿਆਂ ਵਜੋਂ ਭੁਗਤਾਨ ਕੀਤਾ ਜਾਂਦਾ ਹੈ ਪਰ ਹਰੇਕ ਐਪੀਸੋਡ ਦੀ ਸ਼ੁਰੂਆਤ ਵਿੱਚ ਇੱਕ ਡਿਸਕਲੇਮਰ ਕਹਿੰਦਾ ਹੈ ਕਿ ਉਹ ਜੋ ਪੈਸਾ ਨਿਵੇਸ਼ ਕਰਦੇ ਹਨ ਉਹ ਉਹਨਾਂ ਦਾ ਆਪਣਾ ਹੁੰਦਾ ਹੈ ਉਸੇ ਡਿਸਕਲੇਮਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਰਸ਼ਕਾਂ ਨੂੰ ਨਿਵੇਸ਼ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਜਾ ਰਹੀ ਹੈ ਜੋ ਪੈਨਲ ਦਾ ਕੋਈ ਮੈਂਬਰ ਦਿਲਚਸਪੀ ਰੱਖਦਾ ਹੈ ਤਾਂ ਉਦਮੀ ਸ਼ੋਅ 'ਤੇ ਹੱਥ ਮਿਲਾਉਣ ਦਾ ਸੱਦਾ ਮਤਲਬ ਇਕਰਾਰਨਾਮਾ ਕਰ ਸਕਦਾ ਹੈ ਹਾਲਾਂਕਿ ਜੋ ਪੈਨਲ ਦੇ ਸਾਰੇ ਮੈਂਬਰ ਬਾਹਰ ਨਿਕਲ ਜਾਂਦੇ ਹਨ ਤਾਂ ਉਹ ਉਦਮੀ ਖਾਲੀ ਹੱਥ ਚਲਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹ ਸ਼ੋਅ ਵਿੱਚ ਮੀਟਿੰਗਾਂ ਅਤੇ ਉਦਮੀਆਂ ਅਤੇ ਕਾਰੋਬਾਰੀਆਂ ਵਿਚਕਾਰ ਗੱਲਬਾਤ ਦੇ ਡਰਾਮੇ ਨੂੰ ਦਰਸਾਉਂਦਾ ਹੈ ਇੱਕ ਪ੍ਰਤੀਯੋਗੀ ਦੁਆਰਾ ਲਗਭਗ ਪੰਤਾਲੀ ਮਿੰਟ ਦੀ ਪਿੱਚ ਨੂੰ ਲਗਭਗ ਗਿਆਰਾਂ ਮਿੰਟ ਤੱਕ ਸੰਪਾਦਿਤ ਕੀਤਾ ਜਾਂਦਾ ਹੈ ਦੋ ਹਜ਼ਾਰ ਅਠਾਰਾਂ ਤੱਕ ਲਗਭਗ ਪੈਂਤੀ ਹਜ਼ਾਰ ਤੋਂ ਚਾਲੀ ਹਜ਼ਾਰ ਉਦਮੀ ਹਰ ਸੀਜਨ ਵਿੱਚ ਅਰਜ਼ੀ ਦਿੰਦੇ ਹਨ ਲਗਭਗ ਇੱਕ ਹਜ਼ਾਰ ਅਗਲੇ ਪੜਾਅ ਵੱਲ ਵਧਦੇ ਹਨ ਇੱਕ ਸੌ ਪੰਜਾਹ ਸ਼ਾਰਕ ਨੂੰ ਪਿੱਚ ਕਰਦੇ ਹਨ ਅਤੇ ਸੌ ਤੋਂ ਘੱਟ ਇਸ ਨੂੰ ਹਵਾ ਵਿੱਚ ਬਣਾਉਂਦੇ ਹਨ ਜ਼ਿਆਦਾਤਰ ਐਪੀਸੋਡਾਂ ਵਿੱਚ ਪ੍ਰਸਾਰਣ ਘੰਟਾ ਚਾਰ ਪਿੱਚਾਂ ਹੁੰਦੀਆਂ ਹਨ ਸਾਰਕ ਕਾਸਟ ਮੈਂਬਰ ਕੋਵਿਨ ਓਲੇਰੀ ਦਾ ਮੰਨਣਾ ਹੈ ਕਿ ਸ਼ੋਅ ਵਿੱਚ ਕੀਤੇ ਗਏ ਹੱਥ ਮਿਲਾਉਣ 'ਤੇ ਸੱਦੇ ਵਿੱਚ ਲਗਭਗ ਵੀਹ ਪ੍ਰਤੀਸ਼ਤ ਕਦੇ ਵੀ ਲਾਗੂ ਨਹੀਂ ਹੁੰਦੇ ਕਿਉਂਕਿ ਹੱਥ ਮਿਲਾਉਣ ਦੇ ਸੌਦਿਆਂ ਤੋਂ ਬਾਅਦ ਨਿਵੇਸ਼ਕਾਂ ਦੀ ਉਚਿਤ ਜਾਂਚ ਅਤੇ ਪ੍ਰਕਿਰਿਆ ਕੀਤੀ ਜਾਂਦੀ ਹੈ ਜਿਸ ਵਿੱਚ ਉਤਪਾਦ ਦੀ ਜਾਂਚ ਕੀਤੀ ਜਾਂਦੀ ਹੈ ਪ੍ਰਤੀਯੋਗੀਆਂ ਦੇ ਕਾਰੋਬਾਰ ਅਤੇ ਨਿੱਜੀ ਅਤੇ ਵਿੱਤੀ ਜਾਂਚ ਸ਼ਾਮਿਲ ਕੀਤੀ ਜਾਂਦੀ ਹੈ ਸ਼ਾਰਕ ਰਾਬਟ ਹਾਰਜਾਵਿਕ ਦਾ ਮੰਨਣਾ ਹੈ ਕਿ ਉਹਨਾਂ ਵਿੱਚੋਂ ਲਗਭਗ ਨੱਬੇ ਪ੍ਰਤੀਸ਼ਤ ਸ਼ਤ ਕਢਵਾਉਣਾ ਉਦਮੀ ਤੋਂ ਆਉਂਦਾ ਹੈ ਕੁਝ ਮਾਮਲਿਆਂ ਵਿੱਚ ਸਿਰਫ ਪ੍ਰਚਾਰ ਲਈ ਪ੍ਰੋਗਰਾਮ ਵਿੱਚ ਦਿਖਾਈ ਦੇਣ ਕਾਰਨ ਇਹ ਸ਼ੋਅ ਅਕਸਰ ਸ਼ਾਰਕ ਟੈਂਕ ਪ੍ਰਭਾਵ ਵੱਲੋਂ ਜਾਣ ਵਾਲੇ ਲਈ ਜ਼ਿੰਮੇਦਾਰ ਹੁੰਦਾ ਹੈ ਪੇਸ਼ਕਸ਼ ਪ੍ਰਾਪਤ ਕੀਤੇ ਬਿਨਾਂ ਵੀ ਸ਼ੋਅ 'ਤੇ ਦਿਖਾਈ ਦੇਣਾ ਕੰਪਨੀਆਂ ਨੂੰ ਵਿਕਰੀ ਨੂੰ ਮਹੱਤਵਪੂਰਨ ਤੌਰ 'ਤੇ ਵਧਾਉਣ ਦੀ ਸੰਭਾਵਨਾ ਰੱਖਦਾ ਹੈ ਕੁਝ ਉਦਮੀਆਂ ਦੇ ਨਾਂ 'ਤੇ ਰੋਜ਼ਾਨਾ ਆਮਦਨੀ ਵਿੱਚ ਦਸ ਤੋਂ ਵੀਹ ਪਰਸੈਂਟ ਵਾਧਾ ਹੁੰਦਾ ਹੈ ਸ਼ੋਅ ਦੇ ਲੰਬੇ ਸਮੇਂ ਤੋਂ ਸ਼ਾਰਕ ਰਾਬਟ ਹਰਜਾਵੇਕ ਅਤੇ ਕੋਵਨ ਅਲੇਰੀ ਕਨੇਡੀਅਨ ਉਦਮੀ ਹਨ ਜੋ ਪਹਿਲਾਂ ਡਰੈਗੀਨੈਸ ਸਿਰਲੇਖ ਵਾਲੀ ਲੜੀ ਦੇ ਕਨੇਡੀਅਨ ਸ਼ੋਅ 'ਚ